ਕੜਾਹ ਗੁਲਾਬ ਜਾਮੂਨ ਰਸਗੁੱਲੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੀਆਂ ਮਮਾ ਤੋਂ ਬਣਾਉਣੀਆਂ ਸਿੱਖੀਆਂ ਮਮਾ ਅਕਸਰ ਹੀ ਘਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਣਾਉਂਦੇ ਰਹਿੰਦੇ ਸੀ ਅਤੇ ਜਦੋਂ ਮੈਂ ਉਹਨਾਂ ਨੂੰ ਦੇਖਦੀ ਸੀ ਮੇਰਾ ਵੀ ਮਨ ਕਰਦਾ ਸੀ ਕਿ ਮੈਂ ਵੀ ਇਹ ਸਾਰੀਆਂ ਚੀਜ਼ਾਂ ਬਣਾ ਕੇ ਆਪਣੇ ਪਰਿਵਾਰ ਨੂੰ ਖਵਾਵਾਂ ਫਿਰ ਇੱਕ ਦਿਨ ਸਾਉਣ ਦਾ ਮਹੀਨਾ ਸੀਗਾ ਅਤੇ ਮੈਂ ਖੀਰ ਪੁੜੇ ਬਣਾਏ ਜੋ ਕਿ ਮੈਂ ਆਪਣੇ ਮਮਾ ਤੋਂ ਬਣਾਉਣੇ ਸਿੱਖੇ ਉਹਨਾਂ ਨੇ ਮੈਨੂੰ ਸਾੜੇ ਹੀ ਇੰਗਰੀਡੀਐਂਟਸ ਦੱਸੇ ਕਿ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਪੈਂਦੀ ਆ ਅਤੇ ਮਾਲ ਪੂੜੇ ਕਿੱਦਾਂ ਬਣਦੇ ਆ ਅਤੇ ਨਾਲ ਖੀਰ ਵੀ ਬਣਾਈ ਉਹਨਾਂ ਨੇ ਸਾਰੇ ਮੈਨੂੰ ਦੱਸਿਆ ਕਿ ਇਹ ਚੀਜ਼ ਇਦਾਂ ਕਰਨੀ ਇਹ ਚੀਜ਼ ਇਦਾਂ ਕਰਨੀ ਉਹਨਾਂ ਤੋਂ ਮੈਂ ਸਿਖ ਕੇ ਬਹੁਤ ਹੀ ਸਵਾਦ ਬਣਾਏ ਅਤੇ ਮੇਰੇ ਸਾਰੇ ਫੈਮਲੀ ਨੂੰ ਬਹੁਤ ਹੀ ਪਸੰਦ ਆਏ ਜੋ ਕਿ ਮੈਨੂੰ ਬਹੁਤ ਸੌਖਾ ਤਰੀਕਾ ਲੱਗਾ ਪੁੜੇ ਬਣਾਉਣ ਦਾ ਅਤੇ ਮੈਨੂੰ ਇਹ ਸਭ ਤੋਂ ਆਸਾਨ ਪਕਵਾਨ ਲੱਗ ਲੱਗਦਾ ਹੈ ਸਾਰਿਆਂ 'ਚੋਂ ਅਤੇ ਔਖਾ ਦੂਜੀ ਤਰਫ ਔਖਾ ਮੈਨੂੰ ਲੱਗਾ ਜਲੇਬੀ ਇੱਕ ਵਾਰੀ ਮੈਂ ਜਲੇਬੀ ਟ੍ਰਾਈ ਕੀਤੀ ਕਿ ਕਿਉਂ ਨਾ ਮੈਂ ਜਲੇਬੀ ਬਣਾਵਾਂ ਬਟ ਜਲੇਬੀ ਬਣਾਉਣ ਦੇ ਵਿੱਚ ਮੈਨੂੰ ਬਹੁਤ ਹੀ ਮੁਸ਼ਕਿਲ ਆਈ ਅਤੇ ਜਦੋਂ ਮੈਂ ਬਣਾਈ ਤੋਂ ਇਨੀ ਠੀਕ ਵੀ ਨਹੀਂ ਬਣੀ ਅਤੇ ਮੈਂ ਕੋਸ਼ਿਸ਼ ਕਰਦੀ ਰਹਿੰਦੀ ਹਾਂ ਕਿ ਮੈਂ ਜਲੇਬੀ ਬਣਾਉਣੀ ਵੀ ਸਿੱਖਾਂ ਅਤੇ ਉਹ ਸਾਰੇ ਪਕਵਾਨਾਂ ਦੇ ਵਿੱਚੋਂ ਮੈਨੂੰ ਸਭ ਤੋਂ ਔਖਾ ਪਕਵਾਨ ਜੋ ਕਿ ਲੱਗਾ ਜਲੇਬੀ